ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਂਟੀ ਜੀ ਅਸੀਂ ਤੁਹਾਡੇ ਗੁਆਂਢੀ ਨਵੇਂ ਆਏ ਹਾਂ ਜੀ ਤੁਹਾਡਾ ਬੇਟਾ ਜੀ ਬਾਹਰ ਸੀ ਫਿਰ ਓਹਨਾ ਤੋਂ ਨੰਬਰ ਲਿਆ ਜੀ

ਅਸੀਂ ਥੋੜ੍ਹੇ ਦਿਨ ਹੀ ਹੋਏ ਆਇਆਂ ਨੂੰ ਬਸ ਤੁਹਾਡੇ ਲਾਈਕ ਆਹ ਹੀ ਸੇਵਾ ਸੀ ਤੁਸੀਂ ਸਾਨੂੰ ਅਸੀਂ ਇੱਥੇ ਨਵੇਂ ਨਵੇਂ ਆਏ ਹਾਂ ਇੱਥੋਂ ਦਾ ਮਾਹੌਲ ਬਾਰੇ ਕੋਈ ਜਾਣੂ ਸੂਚੀ ਦਿਓ ਜਾਣਕਾਰੀ ਦਿਓ ਸਿੱਖ ਇਤਿਹਾਸ ਦੇ ਰਿਲੇਟਿਵ ਹੋ ਜਾਵੇ ਗੁਰੂਆਂ ਪੀਰਾਂ ਬਾਰੇ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਠੀਕ ਹੈ ਜੀ ਅੱਛਾ ਜੀ ਅੱਛਾ ਆਂਟੀ ਜੀ ਠੀਕ ਹੈ ਆਂਟੀ ਜੀ ਅੱਛਾ ਅੱਛਾ ਜੀ ਨਹੀਂ ਜੀ ਅੱਛਾ ਆਂਟੀ ਜੀ ਠੀਕ ਹੈ ਚਲੋ ਆਂਟੀ ਜੀ ਤੁਸੀਂ ਮੈਨੂੰ ਤੁਹਾਡੇ ਕੋਲ ਇਤਿਹਾਸ ਸੁਣ ਕੇ ਬਹੁਤ ਹੀ ਚੰਗਾ ਲੱਗਿਆ ਤੁਸੀਂ ਵੀ ਮੈਨੂੰ ਆਪਣੇ ਕੋਈ ਨਹੀਂ ਤੁਸੀਂ ਵੀ ਮੈਨੂੰ ਆਂਟੀ ਜੀ ਲੈ ਕੇ ਜਾਣਾ ਇਹਨਾ ਸਥਾਨਾਂ 'ਤੇ ਮੈਂ ਵੀ ਦਰਸ਼ਨ ਕਰਨਾ ਚਾਹੁੰਦੀ ਠੀਕ ਹੈ ਠੀਕ ਹੈ ਆਂਟੀ ਜੀ ਹਾਂਜੀ ਠੀਕ ਠੀਕ ਹੈ ਆਂਟੀ ਜੀ ਮੈਂ ਜਰੂਰ ਜਾਣਾ ਚਾਹਾਂਗੀ ਜੀ ਅੱਛਾ ਸ਼ਾਸ਼ੀਕਾਲ ਆਂਟੀ ਜੀ